ਪੰਜਾਬ ਦੇ ਤਿਉਹਾਰ ਅਤੇ ਪੰਜਾਬ ਦਾ ਸੱਭਿਆਚਾਰ ਜਾਣ ਪਛਾਣ ਪਹਿਲੇ ਕਰੋ ਤੁਸੀਂ ਮੇਲੇ ਅਤੇ ਤਿਉਹਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦੀਆਂ ਖੁਸ਼ੀਆਂ ਚਾਅ ਯਾਦਾਂ ਕਾਮਨਾਵਾਂ ਅਤੇ ਪ੍ਰਕਿਰਤਿਕ ਪ੍ਰਗਟਾਵਾ ਕਰਨ ਵਾਲੇ ਇੱਕ ਸੋਮਾ ਹੁੰਦਾ ਹੈ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਕੁਝ ਤਿਉਹਾਰ ਕੋ ਕੌਮੀ ਪੱਧਰ 'ਤੇ ਮਨਾਏ ਜਾਂਦੇ ਹਨ ਅਤੇ ਕੋਈ ਕੁਛ ਤਿਉਹਾਰ ਇਤਿਹਾਸਿਕ ਪੱਧਰ 'ਤੇ ਮਨਾਏ ਜਾਂਦੇ ਹਨ ਜਿਸ ਵਿੱਚ ਵਿਸਾਖੀ ਪੰਜਾਬ ਦਾ ਸਭ ਤੋਂ ਵੱਡਾ ਤਿਉਹਾਰ ਦੇ ਰੂਪ ਦੇ ਵਿੱਚ ਆਉਂਦਾ ਹੈ ਵਿਸਾਖੀ ਪੰਜਾਬ ਦਾ ਕੌਮੀ ਤਿਉਹਾਰ ਹੈ ਪੰਜਾਬ ਦੀ ਕਿਸਾਨੀ ਤਿਉਹਾਰ ਅਤੇ ਕਿਸਾਨੀ ਤਿਉਹਾਰ ਵੀ ਕਿਹਾ ਜਾਂਦਾ ਹੈ ਇਸ ਤਿਉਹਾਰ ਕਿਸਾਨਾਂ ਦੀ ਮੁੱਖ ਫਸਲ ਬਿਲਕੁਲ ਤਿਆਰ ਹੋ ਜਾਂਦੀ ਹੈ ਇਸ ਤਿਉਹਾਰ ਦੇ ਕਟਾਈ ਕਈ ਖਾਈ ਅਤੇ ਮੇਲੇ ਲਗਾਏ ਕਈ ਥਾਵਾਂ 'ਤੇ ਮੇਲੇ ਲਾਏ ਜਾਂਦੇ ਹਨ ਇਸ ਤਿਉਹਾਰ ਦੇ ਸੰਬੰਧ ਵਿੱਚ ਸਿੱਖ ਧਰਮ ਨਾਲ ਵੀ ਹੈ ਇਸ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ ਅਤੇ ਇਸ ਦਿਨ ਲੋਕ ਗੁਰਦੁਆਰੇ ਜਾਂਦੇ ਹਨ ਉੱਥੇ ਜਾ ਕੇ ਮੱਥਾ ਟੇਕਦੇ ਹਨ ਜਿਨ੍ਹਾਂ ਲੋਕਾਂ ਨੇ ਅੰਮ੍ਰਿਤ ਛਕਣਾ ਹੈ ਉਹ ਅੰਮ੍ਰਿਤ ਛਕਦੇ ਨੇ ਅੰਮ੍ਰਿਤ ਛਕਾਇਆ ਜਾਂਦਾ ਹੈ ਅਤੇ ਲੋਕ ਇਸ ਦਿਨ ਗੁਰੂ ਘਰ ਜਾਣਾ ਬਹੁਤ ਜ਼ਰੂਰੀ ਮੰਨਦੇ ਨੇ ਅਗਲਾ ਤਿਉਹਾਰ ਆਉਂਦਾ ਹੈ ਜੀ ਪੰਜਾਬ ਦਾ ਤੀਆਂ ਦਾ ਤਿਉਹਾਰ ਜੋ ਕਿ ਧੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਪੰਜਾਬੀ ਮੁਟਿਆਰਾਂ ਦਾ ਸਭ ਤੋਂ ਵੱਧ ਮਨਪਸੰਦ ਤਿਉਹਾਰ ਹੁੰਦਾ ਹੈ ਤੀਆਂ ਦਾ ਤਿਉਹਾਰ ਇਹ ਤਿਉਹਾਰ ਸਾਵਣ ਮਹੀਨੇ ਦੀ ਤੀਜ਼ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਚਲਦਾ ਹੈ ਕੁੜੀਆਂ ਇਕੱਠੀਆਂ ਹੋ ਕੇ ਪੀਘਾਂ ਝੂਟਦੀਆਂ ਹਨ ਗਿੱਧਾ ਪਾਉਂਦੀਆਂ ਹਨ ਜਿਨ੍ਹਾਂ ਕੁੜੀਆਂ ਦੇ ਵਿਆਹ ਹੋਏ ਹੁੰਦੇ ਹਨ ਉਹ ਸਾਲ ਦੇ ਪਹਿਲੀ ਤੀਜ਼ ਆਪਣੇ ਪੇਕੇ ਆ ਕੇ ਮਨਾਉਂਦੀਆਂ ਹਨ ਜਿਸ ਵਿੱਚ ਉਹ ਹਰੀਆਂ ਚੂੜੀਆਂ ਪਾਉਂਦੀਆਂ ਹਨ ਅਤੇ ਇਸ ਤਿਉਹਾਰ ਨੂੰ ਬੜੀ ਸੋਹਣੀ ਤਰ੍ਹਾਂ ਆਪਣੀ ਸਖੀਆਂ ਸਹੇਲੀਆਂ ਭੈਣ ਭਰਜਾਈਆਂ ਦੇ ਨਾਲ ਮਨਾਉਂਦੀਆਂ ਹਨ ਇਸ ਤੋਂ ਅਗਲਾ ਤਿਉਹਾਰ ਆਉਂਦਾ ਹੈ ਜੀ ਰੱਖੜੀ ਦਾ ਤਿਉਹਾਰ ਜੋ ਕਿ ਕੌਮੀ ਪੱਧਰ ਦੇ ਉੱਤੇ ਸਾਰੇ ਭਾਰਤ ਵਰਸ਼ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਭੈਣਾਂ ਤਿਆਰ ਤਿਆਰ ਹੋ ਕੇ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ ਹੋਈਆਂ ਰੱਖੜੀ ਬੰਨਣ ਆਪਣੇ ਭਰਾ ਨੂੰ ਜਾਂਦੀਆਂ ਹਨ ਅਤੇ ਉੱਥੇ ਜਾ ਕੇ ਉਹਨਾਂ ਕੋਲੋਂ ਤੋਹਫੇ ਜਾਂ ਪੈਸੇ ਉਹਨਾਂ ਤੋਂ ਉਪਹਾਰ ਦੇ ਤੌਰ 'ਤੇ ਉਹਨਾਂ ਨੂੰ ਮਿਲਦੇ ਹਨ ਇਹ ਤਿਉਹਾਰ ਭੈਣ ਅਤੇ ਭੈਣ ਅਤੇ ਭਰਾ ਦੇ ਪਿਆਰ ਨੂੰ ਪ੍ਰਤੀਕ ਕਰਦਾ ਹੈ ਇਸ ਤੋਂ ਬਾਅਦ ਆਉਂਦਾ ਹੈ ਜੀ ਪੰਜਾਬ ਦੇ ਵਿੱਚ ਲੋਹੜੀ ਦਾ ਤਿਉਹਾਰ ਲੋਹੜੀ ਦਾ ਤਿਉਹਾਰ ਤੇਰਾਂ ਜਨਵਰੀ ਨੂੰ ਮਨਾਇਆ ਜਾਂਦਾ ਹੈ ਅਤੇ ਮਾਘ ਦੀ ਸੰਗਰਾਂਦ ਨੂੰ ਆਉਂਦਾ ਹੈ ਇਹ ਇਸ ਦਿਨ ਲੋਕ ਰਾਤ ਨੂੰ ਪਾਥੀਆਂ ਦੀ ਧੂਣੀ ਲਾ ਕੇ ਅੱਗ ਜਲਾ ਕੇ ਉਹਦੇ ਵਿੱਚ ਮੂੰਗਫਲੀਆਂ ਰਿਓੜੀਆਂ ਪਾਉਂਦੇ ਹਨ ਅਤੇ ਇਸ ਨੂੰ ਬੜੇ ਚਾਅ ਨਾਲ ਮਨਾਉਂਦੇ ਅਤੇ ਖਾਂਦੇ ਹਨ ਅਸੀਂ ਪੰਜਾਬ ਦੇ ਸਾਰੇ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਾਂ ਅਸੀਂ ਸਵੇਰ ਦੇ ਉੱਠ ਕੇ ਨਾਹ ਧੋ ਕੇ ਤਿਆਰ ਹੋ ਕੇ ਅਤੇ ਅਸੀਂ ਇਸ ਤਿਉਹਾਰ ਨੂੰ ਮਨਾਉਣ ਲਈ ਜਾਂਦੇ ਹਾਂ